ਟੈਕਨੋਲਜੀ ਦੀ ਗੱਲ ਕਰੀਏ ਤਾਂ ਬੈਕਿੰਗ ਦੇ ਖੇਤਰ ਦੇ ਵਿੱਚ ਨਾ ਅ ਕਾਫੀ ਕੁਛ ਬਦਲਾਓ ਆਇਆ ਹੈ ਅਤੇ ਅੱਗੇ ਇੱਦਾਂ ਜੇਕਰ ਆਪਾਂ ਬੈਂਕ ਜਾਂਦੇ ਸੀਗੇ ਕੈਸ਼ ਜਮ੍ਹਾਂ ਕਰਵਾਉਣ ਤਾਂ ਸਾਨੂੰ ਲਾਈਨਾਂ ਦੇ ਵਿੱਚ ਲੱਗਣਾ ਪੈਂਦਾ ਸੀ ਅਤੇ ਅੱਜ ਕੱਲ੍ਹ ਬੈਕਿੰਗ ਬੈਕਿੰਗ ਨੇ ਸਾਰੇ ਬੈਂਕਾਂ ਨੇ ਮਸ਼ੀਨਾਂ ਲਵਾ ਦਿੱਤੀਆਂ ਨੇ ਅਤੇ ਉੱਥੋਂ ਤੋਂ ਤੁਸੀਂ ਪੈਸੇ ਜਮ੍ਹਾਂ ਵੀ ਕਰਵਾ ਸਕਦੇ ਹੋ ਕਢਵਾ ਵੀ ਸਕਦੇ ਹੋ ਅਤੇ ਨਵੀਂ ਚੈੱਕ ਬੁੱਕ ਵੀ ਈਸ਼ੂ ਕਰਵਾ ਸਕਦੇ ਹੋ ਅਤੇ ਗੱਲ ਕਰੀਏ ਦਖਲਅੰਦਾਜ਼ੀ ਅ ਕਾਫੀ ਨਾ ਮਤਲਬ ਕਿ ਅੱਜ ਫ ਅੱਜ ਕੱਲ੍ਹ ਫਰੋਡ ਆ ਜਿਹੜੇ ਕਾਫੀ ਵੱਧ ਰਹੇ ਨੇ ਇਸ ਨਾਲ ਅਤੇ ਕੋਈ ਫਰੋਡ ਸਾਨੂੰ ਕਾਲ ਕਰਦਾ ਹੈ ਵੀ ਮੈਨੂੰ ਓ ਟੀ ਪੀ ਦਿਓ ਤੁਹਾਡਾ ਇੱਦਾਂ ਤੁਹਾਡੇ ਖਾਤੇ 'ਚ ਪੈਸੇ ਜਮ੍ਹਾਂ ਕਰਵਾਉਣੇ ਨੇ ਅਤੇ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ